ਜੇ ਮੈਂ ਮਸ਼ਹੂਰ ਡਾਂਸਿੰਗ ਯੂਟੀਊਬ ਚੈਨਲ ਦੀ ਗੱਲ ਕਰਾਂ ਤਾਂ ਮਿੱਕੀ ਸਿੰਘ ਅਤੇ ਐਸ਼ਲੇ ਕੌਰ ਦਾ ਯੂਟੀਊਬ ਚੈਨਲ ਨੂੰ ਮੈਂ ਫੋਲੋ ਕਰਦਾ ਹਾਂ ਜੋ ਭੰਗੜੇ ਨੂੰ ਪ੍ਰੋਮੋਟ ਕਰਦੇ ਹਨ ਅਤੇ ਇਵੈਂਟ ਵੀ ਔਰਗੇਨਾਈਜ਼ ਕਰਦੇ ਹਨ ਇਸ ਵਿੱਚ ਉਹ ਸਿਰਫ਼ ਲੋਕ ਨਾਚ ਭੰਗੜੇ ਨੂੰ ਹੀ ਪ੍ਰੋਮੋਟ ਕਰਦੇ ਹਨ